ਜਰਮਨੀ ਸੈਮਰੋਸ ਐਪਰੀਕੋ ਡੈਨਿਸ਼ ਪਰੋਫਿਟਕੌਣਸ ਬੁਕਲਾਵਾ ਚਾਈਨੀਜ ਕਸਟਡ ਟਰਾਂਸ ਰੋਕੀ ਰੋਡ ਕੈਪਸ ਲੈਮਨ ਮਾਰਕਿੰਗ ਟਾਰਸ ਟੋਫੀ ਐਪਲ ਪਾਈਜ ਚੋਕਲੇਟ ਟਾਸਟ ਸਪੈਨਿਸ਼ਪੀਅਰ ਟਾਸਟ ਹਨੀ ਟਾਸਟ ਚੋਕਲੇਟ ਟਾਸਟ